ਹਾਂਜੀ ਮੈਂ ਨਾ ਇਹ ਅਨੁਵਾਦਿਤ ਕਿਤਾਬ ਹੈਗੀ ਹੈ ਰਿਚ ਡੈਡ ਪੂਅਰ ਡੈਡ ਉਹ ਪੜ੍ਹੀ ਹੈ ਅਨੁਵਾਦਿਤ ਹੈ ਪੰਜਾਬੀ ਭਾਸ਼ਾ 'ਚ ਵੀ ਹੈ ਅਤੇ ਜਦੋਂ ਪੜ੍ਹਦੇ ਹਾਂ ਨਾ ਤਾਂ ਇਹ ਪਤਾ ਲੱਗਦਾ ਵੀ ਕਿਸ ਤਰ੍ਹਾਂ ਬਿਜ਼ਨਸ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਜਿਹੜਾ ਨੌਕਰੀ ਕਰਨ ਵਾਲਾ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਜੀਏ ਕਿਸ ਤਰ੍ਹਾਂ ਪੈਸੇ ਦੀ ਬੱਚਤ ਕਰੇ ਇੱਕ ਥੋੜ੍ਹੀ ਥੋੜ੍ਹੀ ਬੱਚਤ ਜਿਹੜੀ ਆ ਉਹ ਇੱਕ ਵੱਡਾ ਕਿਸ ਤਰ੍ਹਾਂ ਉਸ ਮਾਇਆ ਬਣਦੀ ਹੈ ਪੂਰਾ ਇਸ ਕਿਤਾਬ ਦੇ ਵਿੱਚ ਬੜੇ ਸੋਹਣੇ ਤਰੀਕੇ ਨਾਲ ਸਮਝਾਇਆ ਹੋਇਆ ਅਤੇ ਜੋ ਮੈਨੂੰ ਲੱਗਦਾ ਵੀ ਇਹ ਕਿਤਾਬ ਕਈ ਭਾਸ਼ਾ ਦੇ ਵਿੱਚ ਹੈ ਅਤੇ ਇਹ ਆਮ ਜਿਹੜੇ ਵੀ ਜਿਹੜੇ ਕੋਈ ਬੱਚਾ ਜਿਹੜਾ ਹੈ ਦਸਵੀਂ ਤੋਂ ਬਾਅਦ ਜਦੋਂ ਫਰੀ ਹੁੰਦਾ ਬੱਚਾ ਆਪਣਾ ਕੈਰੀਅਰ ਬਾਰੇ ਸੋਚਦਾ ਤਾਂ ਮੈਂ ਇਹ ਚਾਹੁੰਦਾ ਕਿ ਇਹ ਬੱਚਾ ਕਿਤਾਬ ਜ਼ਰੂਰ ਪੜ੍ਹੇ ਜਿਹਦੇ ਵਿੱਚ ਇਹ ਕਲੀਅਰ ਹੁੰਦਾ ਕਿ ਤੁਸੀਂ ਪੈਦਾ ਤਾਂ ਜਿਵੇਂ ਮਰਜ਼ੀ ਹੋ ਸਕਦੇ ਹੋ ਪਰ ਜਦੋਂ ਮਰੋ ਤਾਂ ਘੱਟੋ ਘੱਟ ਤੁਹਾਡੇ ਕੋਲ ਆਪਣਾ ਨਾਮ ਜ਼ਰੂਰ ਹੋਵੇ ਉਹ ਨਾਲ ਪਹਿਚਾਣ ਜ਼ਰੂਰ ਬਣੇ ਤਾਂ ਪਹਿਚਾਣ ਬਣਾਉਣ ਦਾ ਤਰੀਕਾ ਇਸ ਕਿਤਾਬ ਵਿੱਚ ਦੱਸਿਆ ਗਿਆ ਤਾਂ ਵਧੀਆ ਕਿਤਾਬ ਹੈ